ਸਮੇਂ ਦੇ ਨਾਲ ਪੰਜਾਬ ਦੀ ਸੱਭਿਆਚਾਰਕ ਅਤੇ ਕਲਾਤਮਕ ਵਿਰਾਸਤ ਕਿਵੇਂ ਵਿਗਸੀ ਜੇ ਇਸ ਬਾਰੇ ਅਸੀਂ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਿੰਧ ਸੱਭਿਅਤਾ ਦਾ ਜੋ ਅਸਾਰ ਮਿਲਦਾ ਆ ਉਸ ਦੇ ਨਾਲ ਇਹ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਸਿੰਧ ਦੇ ਲੋਕ ਸਿੰਧੂ ਸੱਭਿਅਤਾ ਦੇ ਜੋ ਲੋਕ ਸਨ ਉਹ ਵੱਸਦੇ ਸਨ ਉਹਨਾਂ ਨੇ ਬਹੁਤ ਸਾਰੇ ਆਪਣੇ ਵਪਾਰ ਅਤੇ ਹੋਰ ਬਿਲਡਿੰਗਾਂ ਬਣਾਉਣ ਦੇ ਵਿੱਚ ਇਮਾਰਤਾਂ ਬਣਾਉਣ ਦੇ ਵਿੱਚ ਤਰੱਕੀ ਹਾਸਿਲ ਕੀਤੀ ਹੋਈ ਸੀ ਅਤੇ ਉਸ ਤੋਂ ਬਾਅਦ ਹੌਲੀ ਹੌਲੀ ਪੰਜਾਬ ਦੇ ਵਿੱਚ ਆਰੀਆ ਲੋਕ ਆਏ ਅਤੇ ਉਹਨਾਂ ਦੇ ਨਾਲ ਇੱਥੇ ਰਿਗਵੇਦ ਇੱਕ ਵੈਦਿਕ ਸੱਭਿਅਤਾ ਪੱਲਰੀ ਉਸ ਤੋਂ ਬਾਅਦ ਹੌਲੀ ਹੌਲੀ ਅੱਗੇ ਜਿਉਂ ਜਿਉਂ ਵਿਕਾਸ ਕੀਤਾ ਪੰਜਾਬ ਨੇ ਅਤੇ ਇਸ ਦੇ ਵਿੱਚ ਕਈ ਹੋਰ ਸੱਭਿਆਤਾਵਾਂ ਇਸਲਾਮਿਕ ਸੱਭਿਅਤਾ ਦੇ ਕਰਕੇ ਇੱਥੇ ਵਾਧਾ ਹੋਇਆ ਅਤੇ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਧਰਮ ਦਾ ਜਨਮ ਹੋਇਆ ਜਿਸ ਨੇ ਪੰਜਾਬ ਦੀ ਮੁਹਾਰਤ ਨੂੰ ਬਦਲ ਦਿੱਤਾ ਔਰ ਇੱਥੋਂ ਦੇ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਉੱਤੇ ਲੰਬਾ ਸਮਾਂ ਰਾਜ ਕੀਤਾ ਉਸ ਤੋਂ ਬਾਅਦ ਬ੍ਰਿਟਿਸ਼ ਪ੍ਰਸ਼ਾਸਨ ਦੇ ਕੋਲ ਪੰਜਾਬ ਚਲਾ ਗਿਆ ਅਤੇ ਉਸ ਨੇ ਦੇਸ਼ ਭਗਤਾਂ ਨੂੰ ਬਹੁਤ ਸਾਰਾ ਉਹਨਾਂ ਦਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਅਤੇ ਉਹਦੇ ਵਿੱਚੋਂ ਜ਼ਲ੍ਹਿਆਂ ਵਾਲਾ ਬਾਗ ਦਾ ਸਾਕਾ ਵੀ ਬਹੁਤ ਦੁਖਦਾਈ ਸਾਕਾ ਸੀ ਜਿਸ ਦੇ ਵਿੱਚ ਬਹੁਤ ਬੇਗਿਣਤ ਲੋਕਾਂ ਦੇ ਉੱਤੇ ਨਿਹੱਥੇ ਲੋਕਾਂ ਦੇ ਉੱਤੇ ਗੋਲੀ ਚਲਾਈ ਗਈ ਉਹਨਾਂ ਨੂੰ ਮਾਰਿਆ ਗਿਆ ਉਸ ਦਾ ਉਸ ਦੀ ਯਾਦ ਅੰਮ੍ਰਿਤਸਰ ਦੇ ਵਿੱਚ ਬਣੀ ਹੋਈ ਹੈ